ਮੇਜਰ ਧਿਆਨ ਸ ਧਿਆਨ ਚੰਦ ਮਜੀਸ਼ੀਅਨ ਓਫ ਹੋਕੀ ਸ ਸਚਿਨ ਤੈਂਦੁਲਕਰ ਮਾਸਟਰ ਬਲਾਸਟਰ ਪੀ ਟੀ ਊਸ਼ਾ ਕੁਈਨ ਓਫ ਟਰੈਕ ਮਿਲਖਾ ਸਿੰਘ ਫਲਾਇੰਗ ਓਫ ਸਿੱਖ